ਟੈਕਨੋਲਜੀ ਆ ਜਿਹੜੀ ਇਹਦੇ ਵਿਕਾਸ ਦੇ ਨਾਲ ਮਤਲਬ ਜਿਹੜੀ ਚੱਲੀ ਆ ਇਹ ਟੈਕਨੋਲਜੀ ਇਹਦੇ ਨਾਲ ਕਾਫੀ ਲੋਕਾਂ ਨੂੰ ਮਦਦ ਹੋਈ ਆ ਜਿਸ ਤਰ੍ਹਾਂ ਆਪਣੇ ਫੋਨ ਵਗੈਰਾ ਇਹਦੇ 'ਤੇ ਕੋਈ ਵੀ ਚੀਜ਼ ਤੁਸੀਂ ਖਰੀਦਣੀ ਆ ਜਾਂ ਤੁਸੀਂ ਵੇਚਣੀ ਆ ਉਹ ਮਦਦ ਮਿਲੀ ਆ ਹੁਣ ਜਿਸ ਤਰ੍ਹਾਂ ਕਿਸੇ ਦਾ ਵੀ ਕੋਈ ਕਾਰੋਬਾਰ ਆ ਉਹ ਸੇਲਜਮੈਨ ਆ ਜੋ ਉਹਨਾਂ ਨੂੰ ਬੁਲਾਉਂਦੇ ਆ ਵੀ ਸਾਡਾ ਪ੍ਰੋਡਕਟ ਤਿਆਰ ਹੋ ਗਿਆ ਜਾਂ ਕੋਈ ਚੀਜ਼ ਉਹਨਾਂ ਤੋਂ ਖਰੀਦਣੀ ਆ ਮੰਗਵਾਉਣੀ ਆ ਤੁਸੀਂ ਉਹ ਉਹਦੇ ਵਿੱਚ ਮਦਦ ਹੋ ਗਈ ਨਹੀਂ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਬੀਬੀਆਂ ਸੀ ਉਹਨਾਂ ਨੂੰ ਜਾਣਾ ਆਉਣਾ ਔਖਾ ਸੀ ਉਹ ਆਪਣਾ ਫੋਨ ਕਰਦੀਆਂ ਨੇ ਆਪਣਾ ਚੀਜ਼ ਮੰਗਵਾ ਲੈਂਦੀਆਂ ਨੇ ਜਾਂ ਸੇਲਜਮੈਨ ਆ ਕੇ ਲੈ ਜਾਂਦਾ ਜਿਸ ਤਰ੍ਹਾਂ ਹੁਣ ਸਾਡਾ ਵੀ ਆਪਣੇ ਅਚਾਰ ਚਟਣੀ ਮੁਰੱਬੇ ਵਗੈਰਾ ਦਾ ਜੋ ਕਾਰੋਬਾਰ ਆ ਚਲਾਇਆ ਹੋਇਆ ਸਾਡਾ ਉਹ ਅਸੀਂ ਆਪਣਾ ਜੋ ਵੀ ਸਮਾਨ ਚਾਹੀਦਾ ਸਾਨੂੰ ਉਹ ਵੀ ਮੰਡੀ ਦੇ ਵਿੱਚੋਂ ਮਿਲ ਜਾਂਦਾ ਜਾਂ ਬਾਜ਼ਾਰ ਦੇ ਵਿੱਚੋਂ ਕੋਈ ਵੀ ਮੰਗਵਾਉਣਾ ਜਾਂ ਅਸੀਂ ਜਦੋਂ ਵਿਕਰੀ ਕਰਨੀ ਆ ਆਪਣਾ ਭੇਜਣਾ ਸਮਾਨ ਬਾਹਰ ਕਿਸੇ ਨੇ ਲੈ ਕੇ ਜਾਣਾ ਅਸੀਂ ਅਗਲੇ ਨੂੰ ਆਡਰ 'ਤੇ ਬਣਾ ਦਿੰਦੇ ਹਾਂ ਚੀਜ਼ ਅਤੇ ਅਗਲਾ ਫੋਨ ਕਰੇ 'ਤੇ ਸਾਡਾ ਸਮਾਨ ਲੈ ਕੇ ਚਲੇ ਜਾਂਦਾ ਇਸ ਤਰ੍ਹਾਂ ਇਹ ਜਿਹੜੀ ਟੈਕਨੋਲਜੀ ਆ ਫੋਨ ਵਗੈਰਾ ਦੀ ਜੋ ਵੀ ਹੈ ਆਪਾਂ ਲੈਪਟੋਪ ਚਲਾਉਂਦੇ ਹਾਂ ਉਹਦੇ ਨਾਲ ਵੀ ਆਪਾਂ ਨੂੰ ਦੁਨੀਆ ਦੇ ਬਹੁਤ ਮਦਦ ਮਿਲਦੀ ਆ ਵੀ ਜਿਸ ਤਰ੍ਹਾਂ ਦੇਖ ਕੇ ਚੀਜ਼ਾਂ ਮ ਇਹ ਬਹੁਤ ਵਧੀਆ ਚੀਜ਼ ਆ ਜਾਣੀ ਦੀ ਇਸ ਚੀਜ਼ ਨੂੰ ਮੈਂ ਮੰਨਦੀ